ਪੰਜ ਜਨਵਰੀ ਉੱਨੀ ਸੌ ਅੱਸੀ ਮੇਰਾ ਜਨਮਦਿਨ ਚਾਰ ਜਨਵਰੀ ਉੱਨੀ ਸੌ ਚੁਰਾਸੀ ਮੇਰੇ ਭਰਾ ਦਾ ਜਨਮਦਿਨ ਛੇ ਫਰਵਰੀ ਦੋ ਹਜ਼ਾਰ ਅੱਠ ਮੇਰੇ ਬੇਟੇ ਦਾ ਜਨਮਦਿਨ ਦੋ ਅਕਤੂਬਰ ਦੋ ਹਜ਼ਾਰ ਛੇ ਸਾਡੇ ਵਿਆਹ ਦੀ ਸਾਲਗਿਰਾ ਅਤੇ ਨਾ ਭੁੱਲਣ ਵਾਲੀ ਡੇਟ ਉੱਨੀ ਜੂਨ ਦੋ ਹਜ਼ਾਰ ਵੀਹ ਜਿਸ ਦਿਨ ਮੇਰੇ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ